ਖੂਹ 'ਚੋਂ ਖੂਹ 'ਚੋਂ ਪਾਣੀ ਕੱਢਣ ਵਾਸਤੇ ਅਸੀਂ ਪੰਪ ਦਾ ਇਸਤੇਮਾਲ ਕਰਦੇ ਹਾਂ ਔਰ ਪੰਪ ਕਿਹੜਾ ਵਰਤਣਾ ਹੈ ਉਹ ਇਸ ਚੀਜ਼ ਦੇ ਉੱਪਰ ਨਿਰਭਰ ਕਰਦਾ ਹੈ ਕਿ ਖੂਹ ਦੇ ਵਿੱਚ ਪਾਣੀ ਦਾ ਜਿਹੜਾ ਲੈਵਲ ਹੈ ਪਾਣੀ ਦੀ ਸਤਾ ਹੈ ਉਹ ਜ਼ਮੀਨ ਦੀ ਸਤਾ ਤੋਂ ਕਿੰਨੀ ਨੀਵੀਂ ਹੈ ਅਗਰ ਪਾਣੀ ਦੀ ਸਤਾ ਜ਼ਮੀਨ ਦੀ ਸਤਾ ਤੋਂ ਜ਼ਿਆਦਾ ਨੀਵੀਂ ਨਹੀਂ ਹੈ ਤਾਂ ਫਿਰ ਅਸੀਂ ਸੈਂਟਰਿਕ ਫਿਊਗਲ ਪੰਪ ਦਾ ਇਸਤੇਮਾਲ ਕਰਦੇ ਹਾਂ ਲੇਕਿਨ ਅਗਰ ਉਹ ਸਤਾ ਔਰ ਜ਼ਮੀਨ ਦੀ ਸਤਾ ਦਾ ਆਪਸ 'ਚ ਫਰਕ ਬਹੁਤ ਜ਼ਿਆਦਾ ਹੈ ਤਾਂ ਫਿਰ ਅਸੀਂ ਸਬਮਰਸੀਬਲ ਪੰਪ ਦੀ ਵਰਤੋਂ ਕਰਦੇ ਹਾਂ ਸਮਰਸੀਬਲ ਪੰਪ ਪਾਈਪ ਦੇ ਨਾਲ ਹੀ ਪਾਣੀ ਦੇ ਵਿੱਚ ਡਿਪ ਕਰ ਦਿੱਤਾ ਜਾਂਦਾ ਹੈ ਜਿੱਥੇ ਕਿ ਪਾਣੀ ਦੀ ਸਤਾ ਤੋਂ ਨੀਚੇ ਚਲਾ ਜਾਂਦਾ ਹੈ ਔਰ ਉਹ ਜਦੋਂ ਚੱਲਦਾ ਹੈ ਪਾਣੀ ਨੂੰ ਆਪਣੇ ਨਾਲ ਚੱਕ ਕੇ ਉਹਨੂੰ ਪ੍ਰੈਸ਼ਰ ਕ੍ਰੀਏਟ ਕਰਕੇ ਪਾਣੀ ਨੂੰ ਧਰਤੀ ਦੀ ਸਤਾ ਤੋਂ ਉੱਪਰ ਜਿਹੜਾ ਹੈ ਉਹ ਟ੍ਰਾਂਸਫਰ ਕਰ ਦਿੰਦਾ ਹੈ ਜਦਕਿ ਸੈਂਟਰਿਕ ਫਿਊਗਲ ਪੰਪ ਜਿਹੜਾ ਹੈ ਉਹ ਪੰਪ ਜ਼ਮੀਨ ਦੀ ਸਤਾ 'ਤੇ ਲੱਗਦਾ ਹੈ ਅਤੇ ਉਹਦੇ ਵਿੱਚੋਂ ਇੱਕ ਪਾਈਪ ਦੇ ਰਾਹੀਂ ਪਾਣੀ ਜਿਹੜਾ ਹੈ ਪਾਣੀ ਦੀ ਸਤਾ ਤੋਂ ਚੁੱਕ ਕੇ ਜ਼ਮੀਨ ਦੀ ਸਤਾ ਉੱਪਰ ਲਿਆਂਦਾ ਜਾਂਦਾ ਇਸ ਤੋਂ ਇਲਾਵਾ ਅਗਰ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਹੈ ਕਿ ਪਾਣੀ ਦੀ ਸਤਾ ਜ਼ਮੀਨ ਦੀ ਸਤਾ ਤੋਂ ਕਾਫੀ ਨੀਚੇ ਹੈ ਲੇਕਿਨ ਇੰਨੀ ਨੀਚੇ ਨਹੀਂ ਹੈ ਕਿ ਸਬਮਰਸੀਬਲ ਪੰਪ ਦੀ ਜ਼ਰੂਰਤ ਪਵੇ ਫਿਰ ਉਸ ਸੂਰਤ ਵਿੱਚ ਅਸੀਂ ਜਿਹੜਾ ਸੈਂਟਰਿਕ ਫਿਊਗਲ ਪੰਪ ਹੈ ਉਹ ਜ਼ਮੀਨ ਦੀ ਸਤਾ ਤੋਂ ਥੋੜ੍ਹਾ ਨੀਚੇ ਖੂਹ ਦੇ ਵਿੱਚ ਜਾ ਕੇ ਕੁਝ ਫਿਟ ਤੱਕ ਨੀਚੇ ਜਾ ਕੇ ਉਹ ਪੰਪ ਰੱਖ ਦਿੰਦੇ ਹਾਂ ਜਿਸ ਕਾਰਨ ਪੰਪ ਦੀ ਕਾਬਲੀਅਤ ਅਤੇ ਪੰਪ ਦੀ ਐਫੀਸ਼ੀਐਂਸੀ ਜਿਹੜੀ ਆ ਉਹ ਬਹੁਤ ਵਧੀਆ ਹੋ ਜਾਂਦੀ ਹੈ ਸਾਨੂੰ ਸਬਮਰਸੀਬਲ ਪੰਪ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ